ਸਾਡੀ ਸਟੇਟ ਟ੍ਰਾਂਸਪੋਰਟ ਦੀ ਕੋਆਲਟੀ ਬਹੁਤ ਵਧੀਆ ਹੈ ਬੱਸਾਂ ਵਿੱਚ ਵਧੀਆ ਸੀਟਾਂ ਹਨ ਨਵੀਆਂ ਬੱਸਾਂ ਹਨ ਅਤੇ ਸਰਕਾਰ ਵੱਲੋਂ ਬੱਸ ਅੱਡੇ ਵੀ ਬਹੁਤ ਵਧੀਆ ਬਣਾ ਦਿੱਤੇ ਗਏ ਹਨ ਜਿਹਨਾਂ 'ਤੇ ਬੱਸਾਂ ਆ ਕੇ ਰੁੱਕਦੀਆਂ ਹਨ ਅਤੇ ਸਵਾਰੀਆਂ ਦੇ ਚੜ੍ਹਨ ਉਤਰਨ ਵਾਸਤੇ ਬਹੁਤ ਵਧੀਆ ਫੈਸੀਲੀਟੀ ਬਣਾ ਦਿੱਤੀ ਗਈ ਹੈ ਅਤੇ ਅਧਾਰ ਕਾਰਡ ਦੀ ਫੈਸੀਲੀਟੀ ਦੇ ਦਿੱਤੀ ਗਈ ਹੈ ਲੇਡੀਜ਼ ਨੂੰ ਫ਼ਰੀ ਸਰਵਿਸ ਕਿਰਾਇਆ ਕਰ ਦਿੱਤਾ ਗਿਆ ਹੈ ਜਿਸ ਨਾਲ਼ ਲੇਡੀਜ਼ ਨੂੰ ਬਹੁਤ ਫਾਇਦਾ ਹੋਇਆ ਹੈ ਅਤੇ ਸਰਕਾਰ ਬਹੁਤ ਵਧੀਆ ਕਦਮ ਚੁੱਕ ਰਹੀ ਹੈ ਬੁਢਾਪਾ ਬੰਦਿਆਂ ਵਾਸਤੇ ਵੀ ਫਰੀ ਸਫ਼ਰ ਕਰਵਾ ਰਹੀ ਹੈ ਅਤੇ ਸੜਕਾਂ ਵੀ ਬਹੁਤ ਵਧੀਆ ਬਣਾ ਦਿੱਤੀਆਂ ਗਈਆ ਹਨ ਜਿਹਨਾਂ ਕਰਕੇ ਸਮਾਂ ਵੀ ਘੱਟ ਲੱਗਦਾ ਹੈ ਕਿਤੇ ਸਫ਼ਰ ਕਰਨ ਵਿੱਚ ਪਹਿਲਾਂ ਬਹੁਤ ਜ਼ਿਆਦਾ ਟਾਈਮ ਲੱਗਦਾ ਸੀ ਹੁਣ ਸੜਕਾਂ ਨਵੀਆਂ ਹੋਣ ਦੇ ਕਾਰਨ ਸ ਸਮਾਂ ਬਹੁਤ ਘੱਟ ਲੱਗਦਾ ਹੈ ਅਤੇ ਅਰਾਮਦਾਇਕ ਸਫ਼ਰ ਹੋ ਜਾਂਦਾ ਹੈ